ਅੰਧ ਵਿਸ਼ਵਾਸ ਅੰਧ ਵਿਸ਼ਵਾਸ ਬਾਰੇ ਮੇਰਾ ਇਹ ਕਹਿਣ ਦਾ ਵਿਚਾਰ ਇਹ ਹੈ ਕਿ ਕਈ ਹੁੰਦੇ ਹੈਗੇ ਆਪਣੇ ਅੰਧ ਵਿਸ਼ਵਾਸ ਵਿੱਚ ਫਸੇ ਹੁੰਦੇ ਹੈ ਜਿਵੇਂ ਕਿ ਉਦਾਹਰਨ ਤੌਰ 'ਤੇ ਕਈ ਤਰ੍ਹਾਂ ਦੇ ਬਾਬੇ ਉਹ ਬਾਬਿਆਂ ਕੋਲ ਜਾ ਜਾ ਕੇ ਉਹਨਾਂ ਦੇ ਹੀ ਟੂਣੇ ਟਪੂਣੇ ਸਿੱਖ ਆਉਂਦੇ ਆ ਅਤੇ ਉਹ ਮੈਂ ਕਈ ਜਗ੍ਹਾਵਾਂ 'ਤੇ ਦੇਖਿਆ ਜਿਵੇਂ ਕੀ ਚੌਰਾਹੇ ਰਸਤੇ 'ਤੇ ਦੀਵਾ ਬਾਲਣਾ ਹੋ ਗਿਆ ਬੋਕਰ ਵਗੈਰਾ ਹੋਰ ਨਿੰਬੂ ਵਗੈਰਾ ਹੋਰ ਕਈ ਤਰ੍ਹਾਂ ਦੀ ਟੂਣੇ ਹੁੰਦੇ ਹੈ ਇਸ ਨਾਲ ਜੋ ਕਿ ਸਮਾਜ ਨੂੰ ਅੰਧਕਾਰ ਵਿੱਚ ਅੰਧ ਵਿਸ਼ਵਾਸ ਸਮਝ ਲੈ ਅੰਧ ਵਿਸ਼ਵਾਸ ਨੂੰ ਸਮਝ ਕੇ ਵਿਸ਼ਵਾਸ ਕਰ ਲੈਂਦੇ ਆ ਉਸ ਅੰਧ ਵਿਸ਼ਵਾਸ ਕਰਕੇ ਹੀ ਸਾਡਾ ਸਮਾਜ ਹੈ ਜੋ ਕਿ ਵਿਸ਼ਵਾਸ ਤੌਰ 'ਤੇ ਤਾਂ ਸਮਰਥਨ ਹੀ ਹੈ ਪਰ ਅੰਧ ਵਿਸ਼ਵਾਸ ਵਿੱਚ ਜ਼ਿਆਦਾ ਉਤਸ਼ਾਹਿਤ ਹੋ ਰਿਹਾ ਇਸ ਲਈ ਸਾਨੂੰ ਅੰਧ ਵਿਸ਼ਵਾਸ 'ਤੇ ਕਦੇ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਇਸ ਨਾਲ ਸਾਡੇ ਸਮਾਜ ਵਿੱਚ ਅੰਧ ਵਿਸ਼ਵਾਸੀ ਜਾਗਰੂਕਤਾ ਹੁੰਦੀ ਆ ਸਾਨੂੰ ਇਹਨਾਂ ਗੱਲਾਂ 'ਤੇ ਯਕੀਨ ਨਹੀਂ ਕਰਨਾ ਚਾਹੀਦਾ